ਅੱਜ ਕੱਲ੍ਹ ਨਿਯਮਿਤ ਤੌਰ 'ਤੇ ਵਿਦਿਆਰਥੀਆਂ ਨੂੰ ਸਕੂਲ ਜਾਣ ਨਾ ਜਾਣ ਦੇਣ ਦੇ ਸਭ ਤੋਂ ਨਿਯਮਿਤ ਅਤੇ ਗੰਭੀਰ ਕਾਰਨ ਇਹ ਹਨ ਕਿ ਕਈਆਂ ਦੇ ਘਰ ਉਹਨਾਂ ਨੂੰ ਪ੍ਰੋਬਲਮਸ ਜਾਂ ਫਿਰ ਦੁਰਘਟਨਾਵਾਂ ਕਰਕੇ ਉਹਨਾਂ ਨੂੰ ਸਕੂਲ ਜਾਂ ਵਿੱਦਿਆ ਮੰਦਰ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਉਹਨਾਂ ਦੇ ਘਰ ਦੇ ਮਾਂ ਪਿਓ ਕਈ ਕਹਿੰਦੇ ਹਨ ਕਿ ਤੁਸ ਤੁਸੀਂ ਕੰਮ ਕਰਕੇ ਤੁਸੀਂ ਪੜ੍ਹ ਕੇ ਕੀ ਕਰਨਾ ਹੈ ਅਤੇ ਉਹਨਾਂ ਨੂੰ ਘਰ ਦੇ ਕੰਮਾਂ ਵਿੱਚ ਲਾ ਦਿੰਦੇ ਹਾਂ ਅਤੇ ਨਾਲ ਹੀ ਨਾਲ ਕਈਆਂ ਦੇ ਘਰ ਓ ਸਕੂਲ ਤੋਂ ਦੂਰ ਪੈਂਦੇ ਹਨ ਉਹਨਾਂ ਦੇ ਆਵਾਜਾਈ ਦੇ ਕਈਆਂ ਦੇ ਸਾਧਨ ਨਹੀਂ ਹੁੰਦੇ ਜਿਹਦੇ ਕਰਕੇ ਉਹਨਾਂ ਨੂੰ ਸਕੂਲ ਤੋਂ ਹਟਵਾ ਦਿੱਤਾ ਜਾਂਦਾ ਹੈ ਅਤੇ ਘਰ ਦੇ ਕੰਮਾਂ ਵਿੱਚ ਲਵਾ ਦਿੱਤਾ ਜਾਂਦਾ ਹੈ ਇਹਦੇ ਕਰਕੇ ਸਾਨੂੰ ਇਹਨਾਂ ਦੇ ਹਰ ਇੱਕ ਪ੍ਰੋਬਲਮ ਹਰ ਇੱਕ ਦੂਰ ਦੁਰਵਿਵਹਾਰਾਂ ਦੇ ਵਿੱਚ ਉਲਝ ਕੇ ਰਹਿ ਜਾਣਾ ਪੈਂਦਾ ਹੈ ਇਸਦੇ ਕਰਕੇ ਇਹਨਾਂ ਦੀਆਂ ਮੁਸ਼ਕਿਲਾਂ ਪੈਸੇ ਦੀਆਂ ਤੰਗੀਆਂ ਘਰ ਦੇ ਵਿੱਚ ਪੈਸੇ ਦੀ ਤੰਗੀ ਹੋਣਾ ਵੀ ਇੱਕ ਮੁੱਖ ਕਾਰਨ ਹੋ ਜਾਂਦਾ ਹੈ ਜਿਹਦੇ ਕਰਕੇ ਲੋਕਾਂ ਦੇ ਵਿੱਚ ਸਕੂ ਬੱਚਿਆਂ ਨੂੰ ਪੜ੍ਹਾਉਣ ਦਾ ਕੋਈ ਵੀ ਉਤਸਾਹ ਨਹੀਂ ਰਹਿ ਜਾਂਦਾ ਜਿਸ ਦੇ ਮਾਂ ਪਿਓ ਨਾ ਹੋਣ ਉਹਨਾਂ ਨੂੰ ਵੀ ਇੱਕ ਬਹੁਤ ਵੱਡੀ ਤੰਗੀ ਹੋ ਜਾਂਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਘਰੋਂ ਪ ਪੜ੍ਹਨ ਵਾਸਤੇ ਨਹੀਂ ਭੇਜਿਆ ਜਾਂਦਾ ਇਸ ਕਰਕੇ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਹੈ ਅਤੇ ਇੱਦਾਂ ਆਦੀ ਤਰੀਕਿਆਂ ਦੇ ਬਹੁਤ ਵੱਡੇ ਮੁਸ਼ਕਿਲ ਹਾਲਾਤ ਪੈਦਾ ਨਹੀਂ ਹੋਣੇ ਚਾਹੀਦੇ ਹਨ